ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਅਸੀਂ ਨਾ ਬਠਿੰਡਾ ਤੋਂ ਆਏ ਹੋਏ ਹਾਂ ਜੀ ਵਿਜ਼ਿਟ ਕਰਨ ਲਈ ਮੋਹਾਲੀ ਏਰੀਆ ਦਾ ਅਤੇ ਇੱਧਰ ਆਪਣਾ ਗੁਰਦੁਆਰਾ ਸਾਹਿਬ ਨੇੜੇ ਤੇੜੇ ਦੇ ਜਿਹੜੇ ਧਾਰਮਿਕ ਅਸਥਾਨ ਹੈ ਉਹਨਾਂ ਦੀ ਯਾਤਰਾ ਕਰਨਾ ਚਾਹੁੰਦੇ ਹਾਂ ਤੁਸੀਂ ਸਾਨੂੰ ਦੱਸ ਸਕਦੇ ਹਾਂ ਹਾਂਜੀ ਕਿਹੜੇ ਕਿਹੜੇ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਹੈ ਕਿਹੜਾ ਏਰੀਆ ਕਿੱਧਰ ਲੀ ਸਾਈਡ ਨੂੰ ਪੈ ਜਾਂਦਾ ਹੈ ਜੀ ਆਪਣਾ ਅੱਛਾ ਅੱਛਾ ਜੀ ਜੇ ਚੰਡੀਗੜ੍ਹ ਤੋਂ ਆਪਾਂ ਆਉਣਾ ਹੋਵੇ ਬਾਏ ਠੀਕ ਹੈ ਸਟੋਪੇਜ਼ ਕਿਹੜਾ ਪੁੱਛੀਏ ਫੇਰ ਵੀ ਕਿੱਥੇ ਉਤਰਨਾ ਹੈ ਆਪਾਂ ਕੀ ਕਹਿ ਕੇ ਠੀਕ ਠੀਕ ਹੈ ਜੀ ਠੀਕ ਹੈ ਜੀ ਉੱਥੇ ਰਾਤ ਰਹਿਣ ਦਾ ਪ੍ਰਬੰਧ ਹੈ ਜੀ ਠੀਕ ਠੀਕ ਹੈ ਜੀ ਅਤੇ ਇੱਕ ਅੰਬ ਸਾਹਿਬ ਗੁਰਦੁਆਰਾ ਵੀ ਹੈ ਨਾ ਜੀ ਉਹ ਕਿੱਥੇ ਕੁ ਹੈ ਅਤੇ ਉੱਥੇ ਜਾਣਾ ਹੋਵੇ ਆਪਾਂ ਨੂੰ ਉੱਥੇ ਦੇ ਲਈ ਬੱਸ ਸੁਵਿਧਾ ਇੱਥੋਂ ਹੋਜੇਗੀ ਟਾਈਮਿੰਗ ਦਾ ਤਾਂ ਨਹੀਂ ਹੈ ਕੋਈ ਫ਼ਿਕਸ ਵੀ ਇੰਨੇ ਤੋਂ ਇੰਨੇ ਤੱਕ ਆ ਸਕਦੇ ਹਾਂ ਹੈਨਾ ਅਤੇ ਲੰਗਰ ਕਦੋਂ ਤੱਕ ਬੰਦ ਹੁੰਦਾ ਹੈ ਜੀ ਠੀਕ ਹੈ ਜੀ ਅਤੇ ਹੋਰ ਕੋਈ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਨੇੜੇ ਤੇੜੇ ਹੋਵੇ ਜਿਹੜੇ ਅਸੀਂ ਦੇਖ ਸਕਦੇ ਹੋਈਏ ਅੱਛਾ ਜੀ ਅਤੇ ਇਹਨਾਂ ਇਹਦੀ ਦੂਰੀ ਕਿੰਨੀ ਕੁ ਹੈ ਜੀ ਸੋਹਾਣਾ ਸਾਹਿਬ ਤੋਂ ਅੰਬ ਸਾਹਿਬ ਦੀ ਅੱਛਾ ਜੀ ਚਲੋ ਠੀਕ ਹੈ ਜੀ ਉਕੇ